ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਹਨ ਜਿੱਦਾਂ ਕਿ ਕੋਂਗਰਸ ਬੀਜੇਪੀ ਅਤੇ ਆਮ ਆਦਮੀ ਪਾਰਟੀ ਮਗਰ ਅੱਜ ਕੱਲ੍ਹ ਜੋ ਜੋ ਪੰਜਾਬ ਦੇ ਵਿੱਚ ਪਾਰਟੀ ਕੰਮ ਕਾਜ ਕਰ ਰਹੀ ਹੈ ਜਾਂ ਇਸ ਟਾਈਮ ਸੱਤਾ 'ਤੇ ਹੈਗੀ ਆ ਉਹ ਆਮ ਆਦਮੀ ਪਾਰਟੀ ਹੈ ਜਿਸ ਦਾ ਨਿਸ਼ਾਨ ਝਾੜੂ ਹੈ ਉਹਦਾ ਉਹਦੇ ਜਿਹੜੇ ਸਾਡੇ ਮੁੱਖ ਮੰਤਰੀ ਹਨ ਉਹ ਸ਼੍ਰੀ ਭਗਵੰਤ ਮਾਨ ਜੀ ਹਨ ਅਤੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਤਾਂ ਬਹੁਤ ਵਧੀਆ ਹੈ ਉਹਨਾਂ ਨੇ ਬਹੁਤ ਸਾਰੇ ਬਹੁਤ ਸਾਰੇ ਕੰਮ ਕੀਤੇ ਹਨ ਜੋ ਕਿ ਪੰਜਾਬ ਦੇ ਵੱਖਰੇ ਜਿਹੜੇ ਪਹਿਲੇ ਸੀਗੇ ਪਾਰਟੀਆਂ ਦੇ ਮੈਂਬਰ ਜਾਂ ਮੁੱਖ ਮੰਤਰੀ ਉਹਨਾਂ ਨੇ ਨਹੀਂ ਕੀਤੇ ਸੀ ਹੁਣ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਅਤੇ ਅਸੀਂ ਇਹਨਾਂ ਦੇ ਕੰਮ ਤੋਂ ਬਹੁਤ ਸੰਤੁਸ਼ਟ ਹਾਂ ਇਹਨਾਂ ਨੇ ਬਹੁਤ ਸਾਰੇ ਅਧਿਆਪਕਾਂ ਨੂੰ ਨਵੀਆਂ ਨਵੀਆਂ ਨੌਕਰੀਆਂ ਦਿੱਤੀਆਂ ਹਨ ਅਤੇ ਇਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਸ਼ੇ ਨੂੰ ਘਟਾਉਣ ਵਾਸਤੇ ਬਹੁਤ ਸਾਰੀਆਂ ਸਕੀਮਾਂ ਚਲਾ ਰਹੇ ਹਨ ਇਹਨਾਂ ਨੇ ਸਿਹਤ ਵੀ ਵਿਭਾਗ ਸਿਹਤ ਵਾਸਤੇ ਬਹੁਤ ਸਾਰੇ ਹਸਪਤਾਲ ਖੋਲੇ ਹਨ ਜਿੱਥੇ ਆਮ ਆਦਮੀ ਲੋਕ ਜਾ ਕੇ ਆਪਣਾ ਬਹੁਤ ਹੀ ਘੱਟ ਪੈਸਿਆਂ ਨਾਲ ਇਲਾਜ ਕਰਾ ਸਕਦੇ ਹਾਂ ਲਗਭਗ ਮੁਫਤ ਇਲਾਜ ਹੁੰਦਾ ਹੈ ਉੱਥੇ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਸਹੂਲਤ ਸਾਰੇ ਲੋਕਾਂ ਵਾਸਤੇ ਬਹੁਤ ਹੀ ਵਧੀਆ ਹੈ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਪੰਜਾਬ ਦੇ ਭਵਿੱਖ ਨੂੰ ਅੱਛਾ ਬਣਾ ਰਹੇ ਹਨ ਧੰਨਵਾਦ